ਮੈਨੂੰ ਸਿੰਗਿੰਗ ਦਾ ਕਾਫ਼ੀ ਸ਼ੌਂਕ ਹੈ ਅਤੇ ਮੈਂ ਅਕਸਰ ਹੀ ਆਪਣੇ ਸਕੂਲ ਦੇ ਵਿੱਚ ਅਤੇ ਕਾਲਜ ਦੇ ਵਿੱਚ ਕੰਪਟੀਸ਼ਨਾਂ ਦੇ ਵਿੱਚ ਪਾਰਟੀਸੀਪੇਟ ਕਰਦੀ ਰਹਿੰਦੀ ਹਾਂ ਮੈਨੂੰ ਸਿੰਗਿੰਗ ਕਰਕੇ ਇੱਕ ਕਾਫ਼ੀ ਕਾਫ਼ੀ ਵਧੀਆ ਫੀਲ ਹੁੰਦਾ ਹੈ ਅਤੇ ਇਹ ਮੇਰਾ ਪਰਸਨਲ ਐਕਸਪੀਰੀਅਂਸ ਹੈ ਕਿ ਸਿੰਗਿੰਗ ਮੈਨੂੰ ਸਿੰਗਿੰਗ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਹੈ ਸਿੰਗਿੰਗ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਮੈਂ ਕਾਫ਼ੀ ਵਧੀਆ ਫੀਲ ਕਰਦੀ ਹਾਂ ਮੈਨੂੰ ਕਈ ਸਿੰਗਰ ਬਹੁਤ ਵਧੀਆ ਲੱਗਦੇ ਹਨ ਜਿਵੇਂ ਕਿ ਸੱਜਣ ਦੀਪ ਸੱਜਣ ਦੀਪ ਮੇਰਾ ਫੇਰੇਵਰੇਟ ਸਿੰਗਰ ਹੈ ਜਿਹਨੂੰ ਕਿ ਮੈਂ ਬਹੁਤ ਲਾਈਕ ਕਰਦੀ ਹਾਂ ਅਤੇ ਉਸ ਉਹਨਾਂ ਦੇ ਹੀ ਸੌਂਗ ਗਾਉਂਦੀ ਹਾਂ ਅਤੇ ਮੈਂ ਆਪਣੇ ਸਕੂਲ ਦੇ ਵਿੱਚ ਇੱਕ ਸੰਗੀਤੇ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਸੀ ਜਿਸ ਦੇ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਰਿਲੇਟਡ ਕੋਈ ਸੌਂਗ ਗਾਇਆ ਸੀ ਅਤੇ ਮੈਂ ਆਪਣੀ ਕਲਾਸ ਦੇ ਵਿੱਚ ਵੀ ਅਕਸਰ ਹੀ ਪਰਫੋਰਮ ਕਰਦੀ ਹਾਂ ਮੇਰਾ ਸੌਂਗ ਸੁਣਨਾ ਸਾਰੇ ਸਟੂਡੈਂਟਸ ਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਮੇਰੇ ਸਰ ਹੀ ਮੈਨੂੰ ਮੋਟੀਵੇਟ ਕਰਦੇ ਹਨ ਕਿ ਮੈਂ ਸਿੰਗਿੰਗ ਕਰਦੀ ਰਹਾਂ ਕਿਉਂਕਿ ਮੇਰੀ ਅਵਾਜ਼ ਬਹੁਤ ਜ਼ਿਆਦਾ ਸੋਹਣੀ ਹੈ ਅਤੇ ਮੈਨੂੰ ਸਿੰਗਿੰਗ ਕਰਦੇ ਰਹਿਣਾ ਚਾਹੀਦਾ ਹੈ ਮੈਂ ਆਪਣੇ ਸਕੂਲ ਦੇ ਵਿੱਚ ਇੱਕ ਕੰਪਟੀਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਸੀ ਜਿੱਥੇ ਕਿ ਮੈਂ ਗੁਰੂ ਦਾ ਸੌਂਗ ਗਾਇਆ ਸੀ ਜਿਸ ਦੇ ਵਿੱਚੋਂ ਮੈਨੂੰ ਇੱਕ ਇਨਾਮ ਵੀ ਮਿਲਿਆ ਸੀ ਅਤੇ ਉਹ ਸੌਂਗ ਕਾਫ਼ੀ ਹੀ ਮਸ਼ਹੂਰ ਮਸ਼ਹੂਰ ਹੈ ਅਤੇ ਉਹ ਮੇਰੇ ਸਿੰਗਰ ਦਲਜੀਤ ਦੋਸਾਂਝ ਜੀ ਦੁਆਰਾ ਗਾਇਆ ਗਿਆ ਹੈ ਮੈਨੂੰ ਦਿਲਜੀਤ ਦੋਸਾਂਝ ਦੇ ਸਾਰੇ ਗੁਰੂ ਸੌਂਗ ਬਹੁਤ ਜ਼ਿਆਦਾ ਵਧੀਆ ਲੱਗਦੇ ਹਨ ਅਤੇ ਮੈਂ ਅਕਸਰ ਹੀ ਗੁਰੂਆਂ ਦੇ ਸੌਂਗ ਗਾਉਂਦੀ ਰਹਿੰਦੀ ਹਾਂ ਕਿਉਂਕਿ ਇਹ ਮੇਰੇ ਮਨ ਨੂੰ ਸਕੂਨ ਦਿੰਦੇ ਹਨ ਅਤੇ ਮੈਨੂੰ ਕਾਫ਼ੀ ਪਸੰਦ ਹਨ ਮੈਨੂੰ ਅਕਸਰ ਹੀ ਸਿੰਗਿੰਗ ਕੋਪਟੀਸ਼ਨਾਂ ਦੇ ਵਿੱਚ ਪਾਰਟੀਸਪੇਟ ਕਰਕੇ ਬਹੁਤ ਵਧੀਆ ਫੀਲ ਹੁੰਦਾ ਹੈ ਕਿਉਂਕਿ ਇਹ ਮੇਰੀ ਫੀਲਿੰਗਸ ਆ ਤੇ ਮੈਂ ਇਸ ਵਿੱਚ ਪਾਰਟੀਸਪੇਟ ਕਰਕੇ ਬਹੁਤ ਵਧੀਆ ਮਹਿਸੂਸ ਕਰਦੀ ਹਾਂ